ਖੇਡਾਂ ਖੇਡਣ ਨਾਲ ਬਹੁਤ ਬਹੁਤ ਹੀ ਜ਼ਿਆਦਾ ਬੱਚਿਆਂ ਦਾ ਆਪਸ ਵਿੱਚ ਪਿਆਰ ਪੈਂਦਾ ਹੈਗਾ ਅਤੇ ਆਹ ਮਤਕੀ ਖੇਡਾਂ ਘਰਾਂ ਵਿੱਚ ਸਾਰੇ ਜਾਣੇ ਇਕੱਠੇ ਹੋ ਕੇ ਖੇਡਦੇ ਆ ਸਾਰੇ ਜਵਾਕ ਇਕੱਠੇ ਹੋ ਕੇ ਖੇਡਦੇ ਆ ਅਤੇ ਆਪਸ ਵਿੱਚ ਉਹਨਾਂ ਦਾ ਪਿਆਰ ਵੱਧਦਾ ਅਤੇ ਬੋਲਣ ਸਿੱਖਣ ਦਾ ਸਾਰਾ ਕੁਛ ਪਤਾ ਲੱਗਦਾ ਕਿ ਫਰੈਂਡਾਂ ਨੂੰ ਕਿਵੇਂ ਬੁਲਾਈਦਾ ਕਿਵੇਂ ਗੱਲ ਕਰੀਦੀ ਆ ਅਤੇ ਖੇਡਾਂ ਖੇਡਣ ਨਾਲ ਉਹਨਾਂ ਦਾ ਸਰੀਰ ਤੰਗਰੁਸ਼ ਰਹਿੰਦਾ ਅਤੇ ਬਿਮਾਰੀਆਂ ਘੱਟ ਲੱਗਦੀਆਂ ਨੇ ਅਤੇ ਇਹੀ ਜ ਜਿਵੇਂ ਉਹ ਘਰਾਂ ਵਿੱਚ ਖੇਡਦੇ ਆ ਅਤੇ ਹੌਲੀ ਹੌਲੀ ਬਾਹਰ ਖੇਡਦੇ ਆ ਅਤੇ ਫਿਰ ਸਕੂਲਾਂ ਵਿੱਚ ਵੀ ਖੇਡਦੇ ਆ ਅਤੇ ਬਹੁਤ ਹੀ ਜ਼ਿਆਦਾ ਜਦੋਂ ਫਿਰ ਕੋਈ ਕਈ ਗੇਮਾਂ ਦੇ ਟੂਰਨਾਮੈਂਟ ਹੁੰਦੇ ਆ ਅਤੇ ਉਹਨਾਂ ਵਿੱਚ ਵੀ ਹਿੱਸਾ ਲੈਂਦੇ ਅਤੇ ਉਹਨਾਂ ਨੂੰ ਫਿਰ ਜ਼ਿਆਦਾ ਪਤਾ ਲੱਗਦਾ ਕਿ ਕਿਵੇਂ ਖੇਡੀ ਦੀਆਂ ਹੁੰਦੀਆਂ ਕਿਤੇ ਆਪਸ ਵਿੱਚ ਦੋਸਤਾਂ ਨਾਲ ਪਿਆਰ ਬਣਾਉਂਦੇ ਆ ਆਂਢ ਗੁਆਂਢ ਦੇ ਜਵਾਕ ਇਕੱਠੇ ਹੋ ਕੇ ਖੇਡਦੇ ਆ ਅਤੇ ਆਪਸ ਵਿੱਚ ਸਾਰਿਆਂ ਦੇ ਹੀ ਬੋਲਣ ਚਾਲਣ ਅਤੇ ਗੱਲਬਾਤ ਵਧੀਆ ਹੁੰਦੀ ਹੈ ਅਤੇ ਆਪਸ ਵਿੱਚ ਦਾ ਪੂਰਾ ਫੁੱਲ ਪਿਆਰ ਹੁੰਦਾ ਗਾ ਅਤੇ ਫਿਰ ਹੌਲੀ ਹੌਲੀ ਵੱਡੇ ਵੱਡੇ ਪੱਧਰਾਂ ਤੱਕ ਜਾਂਦੇ ਆ ਅਤੇ ਬਹੁਤ ਵਧੀਆ ਹੀ ਖੇਡਾਂ ਖੇਡਦੇ ਆ ਅਤੇ ਵੱਧ ਤੋਂ ਵੱਧ ਫਿਰ ਪਿੰਡ ਦੇ ਲੋਕ ਵੀ ਟੂਰਨਾਮੈਂਟ ਕਰਾਉਂਦੇ ਆ ਟੂਰਨਾ ਵਿੱਚ ਵਿੱਚ ਵੀ ਹਿੱਸੇ ਲੈਂਦੇ ਆ ਬਾਹਰਲੇ ਪਿੰਡਾਂ ਦੇ ਵੀ ਆ ਕੇ ਨਾਲ ਟੂਰਨਾ ਵਿੱਚ ਵਿੱਚ ਹਿੱਸਾ ਲੈਂਦੇ ਅਤੇ ਉਹਨਾਂ ਦੀ ਵੱਧ ਤੋਂ ਵੱਧ ਮਤਲਬ ਕਿ ਜਵਾਕਾਂ ਦੀ ਆਪਸ ਵਿੱਚ ਗੱਲਬਾਤ ਹੁੰਦੀ ਆ ਅਤੇ ਖੇਡਾਂ ਖੇਡਣ ਨਾਲ ਹੀ ਇਹਨਾਂ ਦਾ ਪਿਆਰ ਵੱਧਦਾ ਹੈਗਾ ਅਤੇ ਜਦੋਂ ਇਹ ਬਾਹਰ ਖੇਡਾਂ ਖੇਡਣ ਜਾਂਦੇ ਆ ਤਾਂ ਪਿੰਡ ਦਾ ਜਦੋਂ ਬਾਹਰ ਟੂਰਨਾਮੈਂਟ ਵਿੱਚ ਜਾਂਦੇ ਪਿੰਡ ਦਾ ਅਤੇ ਮਾਂ ਪਿਓ ਦਾ ਨਾਮ ਰੋਸ਼ਨ ਹੁੰਦਾ ਹੈਗਾ